ਪਹਿਲਾਂ ਦੇ ਸਮਿਆਂ ਵਿੱਚ ਜਿੱਦਾਂ ਕਿ ਵਿਆਹ ਸ਼ਾਦੀਆਂ ਹੁੰਦੀਆਂ ਤੀਆਂ ਤਾਂ ਜਾਗੋ ਹੁੰਦੀ ਸੀ ਗਿੱਧੇ ਪੈਂਦੇ ਸੀ ਬੋਲੀਆਂ ਪਾਉਂਦੀਆਂ ਸੀ ਕੁੜੀਆਂ ਅਤੇ ਜ ਸਾਰੀ ਲੇਡੀਜ਼ ਇਕੱਠੀਆਂ ਹੋ ਕੇ ਪਰ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਉੱਥੇ ਡਿਜੀਟਲ ਚੀਜ਼ਾਂ ਆ ਗਈਆਂ ਆਪ ਤੋਂ ਬੋਲੀ ਪਾਉਣ ਨਾਲੋਂ ਉਹ ਓਨਲਾਈਨ ਕੋਈ ਵੀ ਰਿਕਾਰਡਡ ਵ ਬੋਲੀਆਂ ਜਾਂ ਸੰਗੀਤ ਲਗਾਉਣਾ ਪ੍ਰੈਫਰ ਕਰਦੇ ਹਨ ਪਹਿਲਾਂ ਦੇ ਸਮਿਆਂ ਦੇ ਵਿੱਚ ਸੱਤ ਸੱਤ ਦਿਨ ਪਹਿਲਾਂ ਇਕੱਠੇ ਹੋ ਕੇ ਸ਼ਾਦੀ ਵਾਲੇ ਘਰ ਹੀ ਇਕੱਠੇ ਹੋ ਜਾਂਦੇ ਸੀ ਅਤੇ ਹਰ ਰੋਜ਼ ਬੋਲੀਆਂ ਸੰਗੀਤ ਹੁੰਦੇ ਸਨ ਪਰ ਅੱਜ ਦੇ ਟਾਈਮ ਦੇ ਵਿੱਚ ਕਿਸੇ ਲਈ ਵੀ ਇੰਨਾ ਟਾਈਮ ਨਹੀਂ ਹੈ ਕਿ ਉਹ ਇੰਨੇ ਐਨ ਟਾਈਮ ਲਈ ਫਰੀ ਛੁੱਟੀ ਲ ਲੈ ਕੇ ਆਪਣੇ ਕੰਮਾਂ ਤੋਂ ਉੱਥੇ ਵਿਆਹ ਸ਼ਾਦੀਆਂ ਅਟੈਂਡ ਕਰ ਸਕੇ ਨਾ ਹੀ ਅੱਜ ਕੱਲ੍ਹ ਇੰਨੀ ਜ਼ਿਆਦਾ ਕਿਸੇ ਨੂੰ ਨੌਲੇਜ ਹੈ ਇਹਨਾਂ ਰੀਤੀ ਰਿਵਾਜ਼ਾਂ ਦੀ ਇਸ ਕਰਕੇ ਹੇ ਆਪਾਂ ਨੇ ਡਿਜੀਟਲ ਮੀਡੀਆ ਕਰਕੇ ਇਹਨਾਂ ਚੀਜ਼ਾਂ ਨੂੰ ਆਸਾਨ ਕਰ ਦਿੱਤਾ ਗਿਆ ਹੈ ਅਤੇ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਰਿਕਾਰਡਡ ਸੋਸ਼ਲ ਮੀਡੀਆ 'ਤੇ ਮਿਲ ਜਾਂਦੀਆਂ ਹਨ ਅਤੇ ਲੋਕ ਉਹ ਹੀ ਯੂਜ ਕਰਨਾ ਪ੍ਰੈਫਰ ਕਰਦੇ ਹਨ ਜਿੱਦਾਂ ਕਿ ਕਿਤੇ ਪੈ ਪਿਛਲੇ ਸਮਿਆਂ ਦੇ ਵਿੱਚ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਸੀ ਤਾਂ ਸਵੱਈਏ ਗਵੱਈਏ ਬੁਲਾਏ ਜਾਂਦੇ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਬੁਲਾਉਣ ਨਾਲੋਂ ਲੋਕ ਡੀ ਜ਼ੇ ਵਗੈਰਾ 'ਤੇ ਪਰੈਫਰ ਜ਼ਿਆਦਾ ਕਰਦੇ ਹਨ ਅਤੇ ਉਹ ਸਾਰੀਆਂ ਚੀਜ਼ਾਂ ਓਨਲਾਈਨ ਜਾਂ ਰਿਕਾਰਡਡ ਹੀ ਪਲੇਅ ਕਰਦੇ ਹਨ ਇਹਨਾਂ ਚੀਜ਼ਾਂ ਨਾਲ ਇੱਕ ਚੀਜ਼ ਦਾ ਫ਼ਾਇਦਾ ਤਾਂ ਹੋਇਆ ਹੈ ਕਿ ਐਨਰਜੀ ਬਚੀ ਹੈ ਲੋਕਾਂ ਦੀ ਬਟ ਉਸ ਚੀਜ਼ ਨਾਲ ਇਹ ਚੀਜ਼ ਹੋਈ ਹੈ ਕਿ ਲੋਕਾਂ ਦਾ ਇਹਨਾਂ ਚੀਜ਼ਾਂ ਦੇ ਵਿੱਚ ਚਾਅ ਘਟ ਗਿਆ ਹੈ ਜਿੱਦਾਂ ਕਿ ਹੁਣ ਵਿਆਹ ਦੇ ਟਾਈਮ ਦੇ ਵਿੱਚ ਜਦੋਂ ਜਾਗੋ ਹੁੰਦੀ ਸੀ ਤਾ ਜਾਗੋ ਇੱਕ ਬੜਾ ਸਾਰਾ ਗੜਬਾ ਹੁੰਦਾ ਸੀ ਜੋ ਕਿ ਉਹ ਪਹਿਲਾਂ ਲੈ ਕੇ ਆਉਂਦੇ ਸੀ ਫਿਰ ਉਹਨੂੰ ਸਜਾਇਆ ਜਾਂਦਾ ਸੀ ਫਿਰ ਉਹਨਾਂ 'ਤੇ ਦੀਵੇ ਰੱਖ ਕੇ ਉਹ ਬਾਲੇ ਜਾਂਦੇ ਸਨ ਅਤੇ ਫਿਰ ਜਾਗੋ ਨਿਕਲਦੀ ਸੀ ਪਰ ਅੱਜ ਕੱਲ੍ਹ ਆਰਟੀਫਿਸ਼ਲਸ ਜਾਗੋ ਮਿਲ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਲਾਈਟਾਂ ਲੱਗੀਆਂ ਹੁੰਦੀਆਂ ਹਨ ਅਤੇ ਉਹਨਾਂ ਦੇ ਵਿੱਚ ਚਿੱਪ ਵੀ ਪ੍ਰੋਵਾਈਡਰ ਹੁੰਦੀ ਹੈ ਜਿਹਦੇ ਵਿੱਚ ਅਸੀਂ ਸੌਂਗਸ ਭਰੇ ਭਰਾਏ ਮਿਲ ਜਾਂਦੇ ਹਨ ਅਤੇ ਉਸ ਚੀਜ਼ ਨਾਲ ਲੋਕ ਖੁਦ ਬੋਲੀਆਂ ਪਾਉਣ ਅਤੇ ਗਾਉਣ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਝਿਜਕਦੇ ਹਨ